ਦੇਖੋ ਸਰਦੀਆਂ ਹੋਣ ਚਾਹੇ ਗਰਮੀਆਂ ਹੋਣ ਪੌਦਿਆਂ ਦੀ ਦੇਖਭਾਲ ਕਰਨੀ ਤਾਂ ਜ਼ਰੂਰੀ ਹੈ ਹੀ ਹੈ ਹੁਣ ਪੌਦੇ ਆਪਾਂ ਆਪਣੇ ਘਰ ਜਗ੍ਹਾ ਲਗਾਏ ਆ ਤਾਂ ਉਹਨਾਂ ਦੀ ਦੇਖਭਾਲ ਤਾਂ ਕਰਨੀ ਪਵੇਗੀ ਅਤੇ ਗਰਮੀਆਂ 'ਚ ਜਿੱਦਾਂ ਕਿ ਆਪਾਂ ਪੌਦਿਆਂ ਨੂੰ ਛਾਵੇਂ ਕਰ ਦਿੰਦੇ ਹਾਂ ਅਤੇ ਸਰਦੀਆਂ ਵਿੱਚ ਆਪਾਂ ਪੌਦਿਆਂ ਨੂੰ ਧੁੱਪ 'ਚ ਰੱਖੂਗੇ ਉਹਨਾਂ ਦੇ ਧਿਆਨ ਨਾਲ ਆਪਾਂ ਉਹਨਾਂ ਦੀ ਜਿਹੜੀ ਗੋਡੀ ਗੁਡੀ ਪਾਣੀ ਉਹਨੂੰ ਟਾਈਮ ਸਿਰ ਪਾਉਂਦੇ ਰਹਾਂਗੇ ਅਤੇ ਸਰਦੀਆਂ 'ਚ ਆਪਾਂ ਤਿਆਰ ਦੇਖਾਂਗੇ ਕਿ ਪੌਦਿਆ ਨੂੰ ਉਸ ਜਗ੍ਹਾ 'ਤੇ ਰੱਖਿਆ ਜਿੱਥੇ ਧੁੱਪ ਆ ਜਾਵੇ ਤਾਂ ਕਿ ਉਹਨਾਂ ਦੀ ਜਿਹੜੀ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਉਹਨਾਂ 'ਚ ਪ੍ਰੋਪਰ ਹੁੰਦੀ ਰਹੇ ਇੱਦਾਂ ਨਾ ਹੋਵੇ ਕਿ ਮਤਲਬ ਪ ਪੌਦਿਆਂ ਨੂੰ ਧੁੱਪ ਹੀ ਨਾ ਲੱਗੇ ਹੈਗੇ ਅਤੇ ਕਿਉਂਕਿ ਸਰਦੀਆਂ ਚੋਂ ਤੁਹਾਨੂੰ ਪਤਾ ਧੁੱਪ ਬਹੁਤ ਘੱਟ ਘੱਟ ਆਉਂਦੀ ਹੈ ਅਤੇ ਇੱਦਾਂ ਨਾ ਹੋਵੇ ਕਿ ਧੁੱਪ ਦੀ ਵਜਹਾ ਨਾਲ ਹੀ ਧੁੱਪ ਤੋਂ ਬਿਨਾਂ ਪੌਦੇ ਸੜ ਹੀ ਪੌਦੇ ਸੁੱਕ ਜਾਣ ਕਿਉਂਕਿ ਪੌਦਿਆਂ ਲਈ ਧੁੱਪ ਬਹੁਤ ਜ਼ਰੂਰੀ ਹੈ ਕਿਉਂਕਿ ਅਗਰ ਧੁੱਪ ਨਹੀਂ ਹੋਵੇਗੀ ਸੰਨ ਲਾਈਟ ਨਹੀਂ ਮਿਲੇਗੀ ਸੂਰਜ ਦੀ ਰੋਸ਼ਨੀ ਨਹੀਂ ਮਿਲੇਗੀ ਤਾਂ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਨਹੀਂ ਹੋਊਗੀ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਨਹੀਂ ਹੋਊਗੀ ਤਾਂ ਪੌਦੇ ਆਪਣਾ ਰੋਟੀ ਨਹੀਂ ਬਣਾ ਪਾਉਣਗੇ ਉਹਦੇ ਕਰਕੇ ਜਿਹੜੇ ਪੌਦੇ ਆ ਉਹ ਫਿਰ ਉਹ ਖਰਾਬ ਹੋ ਜਾਣਗੇ ਇਸ ਕਰਕੇ ਆਪਾਂ ਨੂੰ ਟਰਾਈ ਕਰੋਗੇ ਕਿ ਆਪਾਂ ਪੌਦੇ ਜਿਹੜੇ ਉਹ ਸਹੀ ਸਹੀ ਰਹਿਣ ਅਤੇ ਇਸ ਕਰਕੇ ਆਪਾਂ ਨੂੰ ਪੌਦਿਆਂ ਨੂੰ ਉੱਥੇ ਰੱਖਣਾ ਜਿੱਥੇ ਧੁੱਪ ਹੋਵੇ ਅਤੇ ਉਹਨਾਂ ਨੂੰ ਟਾਈਮ ਟੂ ਟਾਈਮ ਹਲਕਾ ਹਲਕਾ ਪਾਣੀ ਜਿਹੜਾ ਏ ਉਹ ਪੂਰਾ ਬਾਲਟੀਆਂ ਬਾਲਟੀਆਂ ਭਰ ਕੇ ਮੱਗੇ ਮੱਗਿਆ ਨਾਲ ਪਾਣੀ ਦੇਣਾ ਉਹਨਾਂ ਨੂੰ ਹਲਕਾ ਹਲਕਾ ਜਿੰਨਾ ਕੁ ਪਾਣੀ ਦੀ ਜ਼ਰੂਰਤ ਆ ਉੱਨਾਂ ਉੱਨਾਂ ਹੀ ਪਾਣੀ ਦੇਣਾ ਤਾਂ ਕਿ ਟਾਈਮ ਸਿਰ ਉਹਨਾਂ ਨੂੰ ਪੌਦੇ ਵੀ ਸਹੀ ਰਹਿਣ ਪੌਦਿਆਂ ਦੀ ਪਾਣੀ ਦੀ ਕਮੀ ਵੀ ਨਾ ਆਵੇ ਅਤੇ ਪੌਦਿਆਂ 'ਚ ਬਹੁਤ ਜ਼ਿਆਦਾ ਪਾਣੀ ਵੀ ਨਾ ਹੋ ਜਾਵੇ ਅਤੇ ਧਿਪ ਧੁੱਪ ਵੀ ਉਹਨਾਂ ਨੂੰ ਉੱਨੀ ਕ ਪ੍ਰੋਵਾਈਡ ਹੁੰਦੀ ਰਹੇ ਜਿੰਨੀ ਕੁ ਉਹਨਾਂ ਨੂੰ ਲੋੜ ਹੈ ਬਹੁਤ ਜ਼ਿਆਦਾ ਧੁੱਪੇ ਨਹੀਂ ਰੱਖਣਾ ਬਹੁਤ ਜ਼ਿਆਦਾ ਛਾਵੇਂ ਵੀ ਨਹੀਂ ਰੱਖਣਾ ਅਤੇ ਬਸ ਇਸ ਤਰੀਕੇ ਨਾਲ ਬਾਕੀ ਉਹਨਾਂ ਨੂੰ ਖਾਦ ਪਾਉਣੀ ਆ ਗੋਡੀ ਪਾਉਣੀ ਆ ਟਾਇਮ ਟੂ ਟਾਇਮ ਸਭ ਕੁਛ ਤਾਂ ਕਿ ਸਭ ਕੁਛ ਸਹੀ ਸਹੀ ਰਹੇ ਜਿਨ ਚੀਜ਼ ਦੀ ਸਾਨੂੰ ਜ਼ਰੂਰਤ ਹੈ ਜਿੰਨੇ ਜਿਹੜੇ ਜਿਹੜੇ ਪੌਦੇ ਧੁੱਪ 'ਚ ਹੋ ਸਕਦੇ ਹੈ ਉਹਨਾਂ ਨੂੰ ਜਿਹੜਾ ਹੈ ਉਹ ਉਹ ਲਗਾਉਣਾ ਚਾਹੀਦਾ ਜਿਹੜੇ ਨਹੀਂ ਧੁੱਪ 'ਚ ਜਿਹੜੇ ਧੁੱਪ ਨਹੀਂ ਸਹਾਰ ਸਕਦੇ ਉਹਨਾਂ ਨੂੰ ਛਾਵੇਂ ਰੱਖਣਾ ਹੈ